ਹੈਲੋ ਹਾਂ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਂ ਰਾਹੁਲ ਦੀ ਮਦਰ ਬੋਲ ਰਹੀ ਹਾਂ

ਸੋਰੀ ਮੈਡਮ ਜੀ ਮੈ ਕਿਸੇ ਕੰਮ ਤੋਂ ਜ਼ਰੂਰੀ ਕੰਮ ਤੋਂ ਬਾਹਰ ਗਈ ਹੋਈ ਸੀ ਮੈਂ ਇਸ ਘ ਇੱਥੇ ਘਰ ਵਿੱਚ ਨਹੀਂ ਸੀ ਇਸ ਕਾਰਨ ਮੈਂ ਰਾਹੁਲ ਦੀ ਪੇਰੈਂਟਸ ਮੀਟਿੰਗ 'ਤੇ ਨਹੀਂ ਆ ਸਕੀ

ਹਾਂਜੀ ਹਾਂਜੀ ਹਾਂਜੀ ਮੈਡਮ ਜੀ ਉਹ ਤਾਂ ਬਹੁਤ ਮਿਹਨਤ ਕਰਦਾ ਆ ਅਸੀਂ ਤਾਂ ਟਿਊਸ਼ਨ ਵੀ ਰਖਵਾਈ ਹੋਈ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਡਮ ਜੀ ਹੋਰ ਕੋਈ ਹੋਰ ਕੋਈ ਕੰਪਲੇਂਨ ਹੈਗੀ ਆ ਰਾਹੁਲ ਦੀ ਠੀਕ ਹੈ ਮੈਡਮ ਜੀ ਧੰਨਵਾਦ ਮੈਡਮ ਜੀ ਧੰਨਵਾਦ